ਭਾਰਤ ਵਿੱਚ ਭੋਜਨ ਕਈ ਤਰ੍ਹਾਂ ਦਾ ਹੈ ਮਤਲਬ ਨੌਰਥ ਸਾਊਥ ਈਸਟ ਵੈਸਟ ਹਰ ਜਗ੍ਹਾ ਜਗ੍ਹਾ ਦੇ ਹਿਸਾਬ ਨਾਲ ਅਲੱਗ ਅਲੱਗ ਤਰ੍ਹਾਂ ਦਾ ਖਾਣਾ ਭੋਜਨ ਮਿਲਦਾ ਹੈ ਨੌਰਥ ਵਾਲੀਆਂ ਜਗ੍ਹਾਵਾਂ 'ਚ ਜ਼ਿਆਦਾ ਕੁਛ ਪਹਾੜ ਇਲਾਕੇ ਆ ਜਾਂਦੇ ਹਨ ਅਤੇ ਥੋੜ੍ਹਾ ਇੱਕ ਤਰ੍ਹਾਂ ਦਾ ਭੋਜਨ ਮਿਲਦਾ ਹੈ ਈਸਟ ਵਾਲੀ ਸਾਈਡ ਥੋੜ੍ਹੇ ਕਲਚਰ ਰਿਲੀਜਨ ਥੋੜ੍ਹੇ ਕ੍ਰਿਸ਼ਚਨ ਧਰਮ ਦੇ ਹਨ ਅਤੇ ਉਹ ਉਸ ਤਰ੍ਹਾਂ ਦਾ ਭੋਜਨ ਜ਼ਿਆਦਾ ਲੈਂਦੇ ਹਨ ਸਾਊਥ ਇੰਡੀਆ 'ਚ ਸਮੁੰਦਰ ਵਗੈਰਾ ਨਾਲ ਲੱਗਦੇ ਹਨ ਅਤੇ ਉਥੇ ਫਿਸ਼ ਦੀ ਕੰਜਮਸ਼ਨ ਫਿਸ਼ ਦੀ ਮਤਲਬ ਵਰਤੋਂ ਖਾਣਾ ਪੀਣਾ ਜ਼ਿਆਦਾ ਹੁੰਦਾ ਹੈ

ਵੈਸਟ ਸਾਈਡ ਚਲੇ ਜਾਈਏ ਰੇਗਿਸਤਾਨ ਆ ਜਾਂਦਾ ਹੈ ਅਤੇ ਉੱਥੇ ਫਿਰ ਉਸ ਹਿਸਾਬ ਨਾਲ ਫ਼ਰਕ ਪੈਂਦਾ ਹੈ ਅਤੇ ਉਸ ਤਰ੍ਹਾਂ ਦਾ ਭੋਜਨ ਮਿਲਦਾ ਹੈ ਅਗਰ ਮੈਂ ਕੁਛ ਉਦਾਹਰਣਾਂ ਦੇਵਾਂ ਤਾਂ ਨੌਰਥ ਵਿੱਚ ਪੰਜਾਬ ਹਰਿਆਣਾ ਜਾਂ ਫਿਰ ਪਹਾੜੀ ਇਲਾਕਿਆਂ ਚਲੇ ਜਾਈਏ ਤਾਂ ਇੱਥੇ ਥੋੜ੍ਹੇ ਜੋ ਥੋੜ੍ਹੇ ਫੇਮਸ ਭੋਜਨ ਹਨ ਬਟਰ ਚਿਕਨ ਹੋ ਗਿਆ ਪਨੀਰ ਦੀਆਂ ਸਬਜ਼ੀਆਂ ਹੋ ਗਈਆਂ ਦਾਲਾਂ ਹੋ ਗਈਆਂ ਇਹ ਸਭ ਜ਼ਿਆਦਾ ਖਾਦਾ ਜਾਂਦਾ ਹੈ ਨਾਲ ਰੋਟੀ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਸਾਊਥ ਇੰਡੀਆ 'ਚ ਦੇਖ ਲਈਏ ਤਾਂ ਉੱਥੇ ਚਾਵਲ ਜ਼ਿਆਦਾ ਖਾਦੇ ਜਾਂਦੇ ਹਨ ਨਾਲ ਡੋਸਾ ਇਡਲੀ ਸਾਂਬਰ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਿਆਦਾ ਖਾਧੀਆਂ ਜਾਂਦੀਆਂ ਹਨ ਈਸਟ ਵਾਲੀ ਸਾਈਡ ਚਲੇ ਜਾਈਏ ਤਾਂ ਉੱਥੇ ਥੋੜ੍ਹਾ ਜਾ ਸੂਅਰ ਜਾਂ ਥੋੜ੍ਹੇ ਨੋਨ ਵੈੱਜ ਆਈਟਮਾਂ ਜ਼ਿਆਦਾ ਖਾਂਦੇ ਹਨ ਆਪਣਾ ਬੀਫ ਹੋ ਗਿਆ ਪਰਕ ਹੋ ਗਿਆ ਮਟਨ ਚਿਕਨ ਅਲੱਗ ਤਰ੍ਹਾਂ ਦੀ ਰੈਸਪੀਸ ਦੇ ਨਾਲ ਅਤੇ ਬਾਕੀ ਮਿਡ ਵਿੱਚ ਅਤੇ ਰਾਜਸਥਾਨ ਸਾਈਡ ਮੋਸਟਲੀ ਕਾਫ਼ੀ ਨੌਰਥ ਨਾਲ ਮਿਲਦਾ ਜੁਲਦਾ ਹੀ ਹੈ ਬਸ ਥੋੜ੍ਹਾ ਥੋੜ੍ਹਾ ਫ਼ਰਕ ਆ ਜਾਂਦਾ ਹੈ ਬਾਕੀ ਇੰਡੀਆ 'ਚ ਇੰਨੇ ਧਰਮ ਹੋਣ ਦੇ ਕਾਰਨ ਇੰਨੇ ਕਲਚਰ ਹੋਣ ਦੇ ਕਾਰਨ ਇੰਨੇ ਜਗ੍ਹਾਵਾਂ ਤਰ੍ਹਾਂ ਤਰ੍ਹਾਂ ਦੀਆਂ ਹੋਣ ਦੇ ਕਾਰਨ ਬਹੁਤ ਹੀ ਤਰ੍ਹਾਂ ਦਾ ਖਾਣਾ ਮਿਲਦਾ ਹੈ